ਵੈਸੇ ਤਾਂ ਮੇਰਾ ਕੋਈ ਜ਼ਿਆਦਾ ਤਕਨੀਕ ਤਕਨੀਕਾਂ ਦੇ ਹਿਸਾਬ ਨਾਲ ਮੇਰਾ ਕੋਈ ਮਨ ਨਹੀਂ ਹੈ ਕਿਸੇ ਸਿਲਾਈ ਕਢਾਈ ਦੇ ਵਿੱਚ ਪਰ ਮੇਰਾ ਕਦੇ ਕਦੇ ਮਨ ਕਰਦਾ ਹੈ ਕਿ ਮੈਂ ਲੇਡੀਜ ਟੇਲਰ ਦਾ ਕੰਮ ਸਿੱਖਾਂ ਕਿਉਂਕਿ ਉਸ ਵਿੱਚ ਕਾਫੀ ਜ਼ਿਆਦਾ ਮੁਨਾਫਾ ਹੈ ਕਿਉਂਕਿ ਲੇਡੀਜ਼ ਨੇ ਹਰ ਮਹੀਨੇ ਦਸ ਤੋਂ ਪੰਦਰਾਂ ਸੂਟ ਤਾਂ ਸਵਾਉਣੇ ਹੀ ਹੁੰਦੇ ਨੇ ਜਿਸ ਨਾਲ ਕਾਫੀ ਜ਼ਿਆਦਾ ਇਨਕਮ ਔਫ ਸੋਰਸ ਵਧ ਜਾਂਦੀ ਹੈ ਮੇਰਾ ਇੱਕ ਦੋਸਤ ਲੇਡੀਜ ਟੇਲਰ ਹੈ ਉਹ ਕਾਫੀ ਜ਼ਿਆਦਾ ਕਮਾਈ ਕਰ ਰਿਹਾ ਹੈ ਅਤੇ ਮੈਨੂੰ ਵੀ ਸ਼ੌਕ ਹੈ ਕਿ ਮੈਂ ਲੇਡੀਜ ਟੇਲਰ ਦਾ ਸਿੱਖ ਕੇ ਅਤੇ ਉਸ ਵਿੱਚ ਮੁਨਾਫਾ ਕਮਾਵਾਂ ਅਤੇ ਬਾਕੀ ਹਰ ਤਰ੍ਹਾਂ ਦੇ ਸੂਟਾਂ ਦੇ ਡਿਜ਼ਾਇਨ ਅਤੇ ਆਪਣੇ ਸ਼ੋਰੂਮ ਵਿੱਚ ਖੁਦ ਦੀ ਸਿਲਾਈ ਕੀਤੇ ਹੋਏ ਸੂਟ ਰੱਖ ਕੇ ਸਪਲਾਈ ਕਰਾਂ